ਚੌਣਾਂ ਦੇ ਦੌਰਾਨ ਸਾਨੂੰ ਕੋਈ ਖਾਸ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਜਿਹੜੀਆਂ ਚੋਣਾਂ ਐਮਐਲਏ ਦੀਆਂ ਹੁੰਦੀਆਂ ਨੇ ਜਾਂ ਐਮਪੀ ਦੀਆਂ ਹੁੰਦੀਆਂ ਨੇ ਉਸ ਵਿੱਚ ਸੁਰੱਖਿਆ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਜੇ ਆਪਾਂ ਸਮੇਂ ਸਿਰ ਜਾ ਕੇ ਆਪਦੇ ਵੋਟ ਪਾ ਆਈਏ ਤਾਂ ਫਿਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਬਸ ਇੱਕ ਹੀ ਮੁਸ਼ਕਿਲ ਹੁੰਦੀ ਹੈ ਕਿ ਜਨਸੰਖਿਆ ਬਹੁਤ ਜ਼ਿਆਦਾ ਹੋਣ ਕਰਕੇ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ ਨੇ ਅਤੇ ਉਹਨਾਂ ਏਡੀਆਂ ਲੰਬੀਆਂ ਲਾਈਨਾਂ ਦੇ ਵਿੱਚ ਕਈ ਵਾਰ ਆਪਾਂ ਨੂੰ ਕਈ ਕਈ ਘੰਟੇ ਖੜੇ ਹੋਣਾ ਪੈਂਦਾ ਹੈ ਅਤੇ ਉਸ ਦੌਰਾਨ ਜੇ ਕਿਸੇ ਵਿਅਕਤੀ ਨੂੰ ਪਿਆਸ ਲੱਗੇ ਜਾਂ ਉਸ ਨੇ ਕੋਈ ਹੋਰ ਥਕਾਨ ਕਰਕੇ ਜਾਂ ਕਿਸੇ ਹੋਰ ਬਿਮਾਰੀ ਕਰਕੇ ਜੇ ਉਹਨੂੰ ਖੜੇ ਹੋਣ 'ਚ ਥੋੜ੍ਹੀ ਬਹੁਤੀ ਪ੍ਰੋਬਲਮ ਆ ਰਹੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਬੈਠਣ ਦੀ ਜਾਂ ਵਾਸ਼ਰੂਮ ਦੀ ਜਾਂ ਪਾਣੀ ਪੀਣ ਦੀ ਕੋਈ ਅੱਛੀ ਵਿਵਸਥਾ ਨਹੀਂ ਮਿਲਦੀ ਤਾਂ ਮੁਕੰਮਲ ਵਿਵਸਥਾ ਨਾ ਹੋਣ ਕਰਕੇ ਕਈ ਵਾਰੀ ਪ੍ਰੋਬਲਮਸ ਆਉਂਦੀਆਂ ਨੇ